ਜਿਵੇਂ ਕਿ ਸਾਨੂੰ ਪਤਾ ਹੈ ਕਿ ਸ਼ੋਸ਼ਲ ਮੀਡੀਆ ਨੇ ਲੋਕਾਂ ਨੂੰ ਹਰ ਖੇਤਰ ਵਿੱਚ ਪਲੈਟਫਾਰਮ ਦਿੱਤੇ ਨੇ ਜਿਸ ਨਾਲ ਲੋਕ ਆਪਣੀ ਕਲਾਕਾਰੀ ਨੂੰ ਅੱਗੇ ਲਿਆ ਸਕਦੇ ਨੇ ਅਤੇ ਜਿਵੇਂ ਕਿ ਲੋਕਾਂ ਦੀ ਜੋ ਵੀ ਕਲਾ ਹੈ ਉਸ ਨੂੰ ਆਪਾਂ ਸ਼ੋਸ਼ਲ ਮੀਡੀਆ 'ਤੇ ਪਾ ਕੇ ਅਤੇ ਉਸਦੀ ਮਦਦ ਨਾਲ ਬਹੁਤ ਅੱਗੇ ਵੱਧ ਸਕਦੇ ਹਾਂ ਅਤੇ ਜਿਵੇਂ ਕਿ ਆਪਾਂ ਸ਼ੋਸ਼ਲ ਮੀਡੀਆ 'ਤੇ ਕੋਈ ਵੀ ਚੀਜ਼ ਨੂੰ ਪਾਉਂਦੇ ਹਾਂ ਜੇ ਉਹ ਜ਼ਿਆਦਾ ਲੋਕਾਂ ਦੇ ਵਿੱਚ ਚੱਲ ਜਾਂਦੀ ਹੈ ਤਾਂ ਫਿਰ ਸਾਨੂੰ ਇਨਾਮ ਵੀ ਦਿੱਤਾ ਜਾਂਦਾ ਹੈ ਸ਼ੋਸ਼ਲ ਮੀਡੀਆ ਵੱਲੋਂ ਅਤੇ ਆਰਟ ਐਂਡ ਕਰਾਫਟ ਜਿਹੜਾ ਵਾ ਉਹ ਯੂਟਿਊਬ 'ਤੇ ਬਹੁਤ ਸਾਰੇ ਵਧੀਆ ਵਧੀਆ ਚੈਨਲ ਹਨ ਜਿਨਾਂ ਦਾ ਮੈਂ ਉਪਯੋਗ ਕਰਦੀ ਹਾਂ ਅਤੇ ਮੈਨੂੰ ਜਿਵੇਂ ਕਿ ਆਰਟ ਐਂਡ ਕਰਾਫਟ ਦਾ ਬਹੁਤ ਵਧੀਆ ਸ਼ੌਂਕ ਹੈ ਅਤੇ ਉਸ ਤੋਂ ਬਾਅਦ ਜਦੋਂ ਉਹ ਜਿਹੜੇ ਚੈਨਲ ਨੇ ਉਹਨਾਂ ਦੇ ਬਹੁਤ ਵਧੀਆ ਵਧੀਆ ਤਰੀਕੇ ਦੱਸੇ ਹੁੰਦੇ ਹੈ ਅਤੇ ਸੌਖੇ ਤਰੀਕੇ ਦੱਸੇ ਹੁੰਦੇ ਹੈ ਜਦੋਂ ਕੋਈ ਵੀ ਚੀਜ਼ ਮੈਨੂੰ ਔਖੀ ਲੱਗਦੀ ਜਾਂ ਮੈਂ ਕੋਈ ਨਵੀਂ ਚੀਜ਼ ਸਿੱਖਣਾ ਚਾਹੁੰਦੀ ਹਾਂ ਤਾਂ ਮੈਂ ਉਹ ਚੈਨਲਾਂ ਤੋਂ ਵਹਿਨੀ ਜਿਵੇਂ ਆਰਟ ਕਲਾ ਅਤੇ ਇੱਕ ਹੈ ਡੀ ਆਈ ਬਾਏ ਆਰਟ ਡੀ ਆਈ ਬਾਏ ਪੇਪਰ ਕਰਾਫਟ ਇਹ ਚੈਨਲ ਹੀ ਹਨ ਜਿਹੜੇ ਮੈਂ ਜਿਨ੍ਹਾਂ ਦੀ ਵਰਤੋਂ ਕਰਦੀ ਹਾਂ ਅਤੇ ਇਹਨਾਂ ਤੋਂ ਮੈਂ ਸਿੱਖਦੀ ਹਾਂ